ਜਿਵੇਂ ਕਿ ਮੈਂ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧ ਰੱਖਦੀ ਹਾਂ ਮੇਰੇ ਜ਼ਿਲ੍ਹੇ ਵਿੱਚ ਦੇ ਲੋਕ ਖਾਣ ਪੀਣ ਦੇ ਬੜੇ ਸ਼ੌਕੀਨ ਹਨ ਅਤੇ ਉਹ ਖਾਣ ਪੀਣ ਦੇ ਨਾਲ ਨਾਲ ਖਵਾਉਣ ਦੇ ਵੀ ਬੜੇ ਸ਼ੌਕੀਨ ਹਨ ਉਹ ਖਵਾਉਣ ਦੇ ਪਕਾਉਣ ਦੇ ਉਹਨੂੰ ਤਿਆਰ ਕਰਕੇ ਅਲੱਗ ਅਲੱਗ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦਾ ਸਵਾਦ ਚਖਾਉਣ ਵਿੱਚ ਅਤੇ ਚੱਖਣ ਵਿੱਚ ਬੜਾ ਵਿਸ਼ਵਾਸ ਰੱਖਦੇ ਹਨ ਜਿਵੇਂ ਕਿ ਮੇਰੇ ਏਰੀ ਮੇਰੇ ਇਲਾਕੇ ਦੀ ਸਭ ਤੋਂ ਮਸ਼ਹੂਰ ਚੀਜ਼ ਹੈ ਦਾਲ ਮੱਖਣੀ ਦਾਲ ਮੱਖਣੀ ਜਿਹੜੀ ਕਿ ਮਾਂਹਵਾਂ ਦੀ ਦਾਲ ਨੂੰ ਕਿਸੇ ਖੁੱਲ੍ਹੇ ਭਾਂਡੇ ਵਿੱਚ ਖੁੱਲ੍ਹੀ ਅੱਗ ਵਿੱਚ ਪਕਾ ਕੇ ਬਣਾਈ ਜਾਂਦੀ ਆ ਫਿਰ ਉਹਦੇ ਵਿੱਚ ਮੱਖਣ ਪਾ ਕੇ ਉਹਨੂੰ ਉਹਨੂੰ ਪੇਸ਼ ਕੀਤਾ ਜਾਂਦਾ ਸਰਵ ਕੀਤਾ ਜਾਂਦਾ ਹੈ ਹੈ ਨਾ ਜਿਹੜੀ ਕਿ ਬਹੁਤ ਪਸੰਦ ਕੀਤੀ ਜਾਂਦੀ ਚਾਹੇ ਉਹਨੂੰ ਚੌਲਾਂ ਨਾਲ ਉਹਦਾ ਆਨੰਦ ਲਿਆ ਜਾਏ ਅਤੇ ਚਾਹੇ ਉਹਦਾ ਫੁਲਕਿਆਂ ਨਾਲ ਲਿਆ ਜਾਏ ਇਸ ਤੋਂ ਇਲਾਵਾ ਮਿੱਠੇ ਵਿੱਚ ਫਰੂਟ ਕਰੀਮ ਸੱਤ ਪੂੜਾ ਮੇਰੇ ਇਹ ਇਲਾਕੇ ਦੀ ਸਭ ਤੋਂ ਫੇਮਸ ਚੀਜ਼ ਆ ਜਿਹੜੀ ਕਿ ਸਿਰਫ ਸਾਉਣ ਦੇ ਮਹੀਨੇ ਵਿੱਚ ਹੀ ਮਿਲਦੀ ਹੈ ਸੱਤ ਪੜਤਾਂ ਵਾਲਾ ਸੱਤ ਪੂੜਾ ਮਿੱਠਾ ਵੀ ਹੁੰਦਾ ਹੈ ਇਹ ਅਤੇ ਕੁਝ ਇਲਾਕਿਆਂ ਵਿੱਚ ਤਾਂ ਨਮਕੀਨ ਵੀ ਚਲਦਾ ਲੇਕਿਨ ਮੇਰੇ ਸ਼ਹਿਰ ਵਿੱਚ ਮੇਰੇ ਗੁਰਦਾਸਪੁਰ ਵਿੱਚ ਇਹ ਮਿੱਠਾ ਹੀ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ ਇੱਥੋਂ ਦੇ ਲੋਕ ਖਾਣ ਪੀਣ ਦੇ ਵਧੀਆ ਸ਼ੌਕੀਨ ਹਨ ਜੇ ਉਹਨਾਂ ਨੇ ਇੱਥੋਂ ਦਾ ਖਾਣਾ ਪੀਣਾ ਹੋਏ ਚੰਗਾ ਖਾਣ ਪੀਣ ਵਾਸਤੇ ਕਈ ਪ੍ਰਕਾਰ ਦੇ ਇੱਥੇ ਢਾਬੇ ਹਨ ਮੇਰੇ ਗੁ ਹੋਟਲ ਹਨ ਜਿਵੇਂ ਗੁਰਦਾਸਪੁਰ ਦਾ ਜੀ ਐਸ ਕੇ ਢਾਬਾ ਬੜਾ ਮਸ਼ਹੂਰ ਹੈ ਇੱਕ ਅਨਪੂਰਨਾ ਬੜਾ ਮਸ਼ਹੂਰ ਹੈ ਔਰ ਅਨੇਕਾਂ ਢਾਬੇ ਤਾਂ ਹੈ ਹੀ ਹਨ ਧੰਨਵਾਦ